ਸਤਿ ਸ਼੍ਰੀ ਅਕਾਲ ਸਾਡੇ ਪਠਾਨਕੋਟ ਖੇਤਰ ਵਿੱਚ ਬਹੁਤ ਜ਼ਿਆਦਾ ਪਸੰਦੀਦਾ ਪਕਵਾਨ ਜਿਹੜੇ ਹੈਗੇ ਆ ਉਹ ਤਾਂ ਇੱਕ ਪਹਿਲਾਂ ਹੈਗੇ ਆ ਛੋਲੇ ਪੂਰੀਆਂ ਲੋਕ ਛੋਲੇ ਪੂਰੀਆਂ ਬਹੁਤ ਪਸੰਦ ਕਰਦੇ ਆ ਪੂਰੀ ਕੋਈ ਜਨਮਦਿਨ ਹੋ ਜਾਵੇ ਕੋਈ ਕੁਝ ਹੋ ਜਾਵੇ ਲੋਕ ਜ਼ਿਆਦਾ ਇੱਥੇ ਜਿਹੜੀ ਪਸੰਦੀਦਾ ਜਿਹੜੀ ਹੈਗੀ ਆ ਡਿਸ਼ ਉਹ ਮੰਨਦੇ ਆ ਉਹਨੂੰ ਛੋਲੇ ਪੂਰੀਆਂ ਨੂੰ ਪਸੰਦ ਕਰਦੇ ਆ ਜਿਹੜੇ ਬੱਚੇ ਜਾਂ ਫਿਰ ਜਿਹੜੇ ਆਫਿਸ ਵਾਲੇ ਕੁਝ ਜਿਹੜੇ ਬਾਹਰੋਂ ਆਏ ਦੇ ਵੀ ਰਹਿੰਦੇ ਹੈਗੇ ਆ ਉਹ ਵੀ ਜ਼ਿਆਦਾਤਰ ਸਵੇਰੇ ਆਪਣਾ ਨਾਸ਼ਤਾ ਜਿਹੜਾ ਆ ਛੋਲੇ ਪੂਰੀਆਂ ਜਾਂ ਫਿਰ ਨਾਨ ਪੂਰੀ ਉਹ ਹੀ ਪਸੰਦ ਕਰਦੇ ਆ ਜ਼ਿਆਦਾਤਰ ਸਾਡੇ ਇੱਥੇ ਜਿਹੜੀ ਡਿ ਮਤਲਬ ਜਿਹੜੀ ਜਿਹੜਾ ਪਕਵਾਨ ਫੇਮਸ ਆ ਉਹ ਇਹ ਹੀ ਆ ਉਸਤੋਂ ਇਲਾਵਾ ਜੇ ਮਿੱਠੇ ਦੀ ਅਸੀਂ ਗੱਲ ਕਰੀਏ ਤਾਂ ਮਿੱਠੇ 'ਚ ਲੋਕ ਜਲੇਬੀ ਬਹੁਤ ਪਸੰਦ ਕਰਦੇ ਆ ਅਤੇ ਕੁਝ ਤਿਉਹਾਰ ਜਿੱਦਾਂ ਵਿਸਾਖੀ ਵਸੁਖੀ ਆ ਜਾਵੇ ਤਾਂ ਫਿਰ ਜ਼ਿਆਦਾ ਪਸੰਦ ਜਿੱਦਾਂ ਜਲੇਬੀਆਂ ਅਤੇ ਪਕੌੜੇ ਬਹੁਤ ਚੱਲਦੇ ਆ ਹਰ ਇੱਕ ਘਰ 'ਚ ਅਤੇ ਉਹ ਕਿਸੇ ਵੀ ਨਾ ਕਿਸੇ ਵੀ ਆਮ ਦੁਕਾਨ ਤੋਂ ਹਲਵਾਈ ਦੀ ਦੁਕਾਨ ਤੋਂ ਕਹਿ ਲਓ ਤੁਸੀਂ ਜਾਂ ਫਿਰ ਕਿਸੇ ਰੈਸਟੋਰੈਂਟ ਤੋਂ ਕਹਿ ਲਓ ਕਿਤੋਂ ਵੀ ਅਰਾਮ ਨਾਲ ਮਿਲ ਜਾਂਦੇ ਆ ਛੋਲੇ ਪੂਰੀਆਂ ਵੀ ਮਿਲ ਜਾਂਦੇ ਆ ਅਤੇ ਮਿਠਾਈ 'ਚ ਜੇ ਤੁਸੀਂ ਕੁਝ ਖਾਣਾ ਤਾਂ ਉਹ ਵੀ ਪਸੰਦ ਕਰਦੇ ਆ ਅਤੇ ਉੱਦਾਂ ਤਾਂ ਸਾਰੀਆਂ ਜਿਹੜੀਆਂ ਜਿਹੜੇ ਪਕਵਾਨ ਆ ਉਹ ਤਾਂ ਆਮ ਚੱਲਦੇ ਹੀ ਰਹਿੰਦੇ ਆ ਅਤੇ ਕੜੀ ਚੌਲ ਵੀ ਹਾਂ ਇੱਥੋਂ ਦੇ ਲੋਕ ਪਕੌੜਿਆਂ ਵਾਲੀ ਕੜੀ ਤਾਂ ਚੌਲ ਜ਼ਿਆਦਾ ਬਹੁ ਉਹ ਵੀ ਬਹੁਤ ਜ਼ਿਆਦਾ ਮਤਲਬ ਜ਼ਿਆਦਾ ਉਹਦੀ ਡਿਮਾਂਡ ਰਹਿੰਦੀ ਆ ਜ਼ਿਆਦਾ ਲੋਕ ਪਸੰਦ ਕਰਦੇ ਆ ਉਸਤੋਂ ਇਲਾਵਾ ਅੱਜ ਕੱਲ੍ਹ ਦੀ ਜਿਹੜੀ ਸਾਡੀ ਜਿਹੜੀ ਪੀੜ੍ਹੀ ਆ ਜਿਹੜੇ ਸਾਡੀ ਜਿੱਦਾਂ ਕਿ ਆਪਣੇ ਪੰਦਰਾਂ ਤੋਂ ਵੀਹ ਪੱਚੀ ਸਾਲ ਦੀ ਉਮਰ ਦੇ ਜਿਹੜੇ ਬੱਚੇ ਆ ਉਹ ਤਾਂ ਫਾਸਟ ਫ਼ੂਡ ਹੀ ਜ਼ਿਆਦਾ ਪਸੰਦ ਕਰਦੇ ਆ ਅਤੇ ਉਹਨਾਂ ਨੂੰ ਤਾਂ ਜ਼ਿਆਦਾ ਪੀਜ਼ੇ ਬਰਗਰਾਂ ਨਾਲ ਹੀ ਹੁੰਦਾ ਆ ਅਤੇ ਉਹ ਸਾਰੇ ਰੈਸਟੋਰੈਂਟ ਕੋਈ ਕੁਛ ਹੈਗਾ ਆ ਕੋਈ ਕੁਛ ਅਤੇ ਸਭ ਤੋਂ ਮੇਨ ਜਿਹੜੀ ਚੀਜ ਹੈਗੀ ਆ ਉਹ ਹੈ ਚਾਹ ਚਾਹ ਭਾਵੇਂ ਘਰ ਦੀ ਹੋਵੇ ਭਾਵੇਂ ਰੈਸਟੋਰੈਂਟ ਦੀ ਹੋਵੇ ਉਹ ਹਰ ਇੱਕ ਬੰਦੇ ਨੂੰ ਪਸੰਦ ਆ ਹਰ ਇੱਕ ਨੂੰ ਟਾਈਮ 'ਤੇ ਚਾਈਦੀ ਹੈ ਸਾਡੇ ਇੱਥੇ ਚਾਹ ਪੰਜਾਬ 'ਚ ਉਹ ਬਹੁਤ ਜ਼ਿਆਦਾ ਮਤਲਬ ਕਿ ਕਹਿੰਦੇ ਆ ਨਾ ਜ਼ਰੂਰੀ ਚੀਜ ਸਮਝਦੇ ਆ ਹਰ ਕੋਈ